ਪੰਜਾਬ ਵਿੱਚ ਆਵਾਜਾਈ ਦੇ ਪੁਰਾਣੇ ਜਿਹੜੇ ਆਸਾਰ ਸਨ ਜਿੱਦਾਂ ਕਿ ਬੈਲ ਗੱਡੀਆਂ ਆਟੋ ਰਿਕਸ਼ਾ ਬੱਸਾਂ ਸਨ ਜਿਹੜੀਆਂ ਕਿ ਬੜੇ ਹੀ ਪੁਰਾਣੇ ਤਰੀਕੇ ਨਾਲ ਚੱਲਦੀਆਂ ਸਨ ਹੌਲੀ ਹੌਲੀ ਚੱਲਦੀਆਂ ਸਨ ਪਰ ਅੱਜ ਦੇ ਟਾਈਮ ਦੇ ਵਿੱਚ ਲੋਕਾਂ ਨੇ ਅ ਅ ਆਪਣੇ ਘਰ ਵਿੱਚ ਹੀ ਇੰਨੀਆਂ ਗੱਡੀਆਂ ਹਨ ਕਿ ਉਹ ਆਪ ਆਪਣੇ ਆਪ ਹੀ ਇੱਧਰ ਉੱਧਰ ਜਾਣਾ ਪਸੰਦ ਕਰਦੇ ਹਨ ਹੁਣ ਦੇ ਟਾਈਮ 'ਤੇ ਅੱਜ ਕੱਲ੍ਹ ਗੱਡੀਆਂ ਟ੍ਰੇਨਾਂ ਬਹੁਤ ਵਧੀਆ ਚੱਲ ਗਈਆਂ ਹਨ ਜਿੱਦਾਂ ਕਿ ਬੰਦੇ ਭਾਰਤ ਰਨ ਟ੍ਰੇਨ ਚੱਲ ਪਈ ਹੈ ਤਿੰਨ ਚਾਰ ਘੰਟੇ 'ਚ ਦਿੱਲੀ ਪਹੁੰਚਾ ਦਿੰਦੀ ਹੈਗੀ ਹੈ ਅਤੇ ਨਾਲੇ ਅੱਜ ਕੱਲ੍ਹ ਟੈਕਸੀ ਦਾ ਕੰਮ ਬੜਾ ਹੈ ਚੱਲ ਗਿਆ ਹੈ ਲੋਕ ਘਰੋਂ ਘਰੀ ਆਪਣਾ ਟੈਕਸੀ ਬੁਲਾਉਂਦੇ ਹਨ ਅਤੇ ਜਿੱਥੇ ਜਾਣਾ ਹੈ ਜਿੱਥੇ ਮਰਜ਼ੀ ਸ਼ਹਿਰ ਜਾਣਾ ਉੱਥੇ ਜਾ ਕੇ ਪਹੁੰਚ ਜਾਂਦੇ ਹਨ ਪੁਰਾਣੇ ਟਾਈਮ 'ਚ ਵਕਤ ਬਹੁਤ ਲੱਗਦਾ ਸੀ ਪਰ ਹੁਣ ਸੜਕਾਂ ਵੀ ਵਧੀਆ ਬਣ ਗਈਆਂ ਹਨ ਪਹਿਲੇ ਸੜਕਾਂ ਇਹੋ ਇੰਨੀਆਂ ਵਧੀਆਂ ਨਹੀਂ ਹੁੰਦੀਆਂ ਸਨ ਪਰ ਹੁਣ ਦੇ ਟਾਈਮ ਸਰਕਾਰਾਂ ਨੇ ਕੰਮ ਚੰਗੇ ਕੀਤੇ ਹਨ ਜਿਹਦੇ ਕਰਕੇ ਆਉਣ ਜਾਣ ਦਾ ਵਕਤ ਵੀ ਘੱਟ ਗਿਆ ਹੈ ਅਤੇ ਹੁਣ ਹੁਣ ਦੇ ਲੋਕਲ ਕਾਫੀ ਅੱਛੇ ਚੱਲ ਗਏ ਹਨ ਅਤੇ ਤਾਂ ਕਰਕੇ ਚਲਦਾ ਆ ਰਿਹਾ ਹੈ